ਹਾਂਜੀ ਮੈਂ ਬੋਟ ਕੰਪਨੀ ਦੇ ਹੈੱਡਫੋਨਸ ਮੈਂ ਓਡਰ ਕੀਤੇ ਸੀ ਮੈਨੂੰ ਮੇਰੇ ਹੈੱਡਫੋਨਸ ਮਿਲ ਗਏ ਹਨ ਉਨ੍ਹਾਂ ਦੀ ਪੈਚਿੰਗ ਪੈਕੇਜਿੰਗ ਵੀ ਬਹੁਤ ਜ਼ਿਆਦਾ ਜ਼ਬਰਦਸਤ ਸੀ ਅਤੇ ਮੈਂ ਉਨ੍ਹਾਂ ਨੂੰ ਇਸਤੇਮਾਲ ਕਰ ਰਿਹਾ ਹਾਂ ਉਹ ਬਹੁਤ ਅੱਛੇ ਪ੍ਰੋਡਕਟ ਨੇ ਉਨ੍ਹਾਂ ਦਾ ਬੈਕਅੱਪ ਵੀ ਬਹੁਤ ਅੱਛਾ ਹੈ ਅਤੇ ਮੈਨੂੰ ਇਹ ਪ੍ਰੋਡਕਟ ਪਜਾਉਣ ਲਈ ਬਹੁਤ ਬਹੁਤ ਧੰਨਵਾਦ